ਸਰੀਰਿਕ ਕਸਰਤ ਦੇ ਵਿੱਚ ਸਰੀਰ ਦੀ ਕਸ ਸਰੀਰ ਦੀ ਐਕਸਰਸਾਈਜ਼ ਹੁੰਦੀ ਹੈ ਜਿਸਦੇ ਵਿੱਚ ਸਰੀਰ ਨੂੰ ਅਸੀਂ ਸਥਿਰ ਹੋਣ ਤੋਂ ਜਾਂ ਖੜ੍ਹਨ ਤੋਂ ਰੋਕਦੇ ਹਾਂ ਸਰੀਰ ਦੇ ਇਕੱਲਾ ਇਕੱਲਾ ਅੰਗ ਉਸਦਾ ਹਿਲ ਜੁਲ ਕਰਦਾ ਹੈ ਜਿਸ ਨਾਲ ਕਿ ਬੰਦੇ ਦੇ ਵਿੱਚ ਆਲਸ ਘੱਟਦੀ ਹੈ ਅਤੇ ਸਰੀਰ ਦੇ ਵਿੱਚ ਚੁਸਤੀ ਅਤੇ ਤੰਦਰੁਸਤੀ ਆਉਂਦੀ ਹੈ ਯੋਗਾ ਮਾਨਸਿਕ ਹਾਲਤ ਨੂੰ ਬਿਹਤਰ ਕਰਦਾ ਹੈ ਅਤੇ ਮਨੁੱਖ ਦਾ ਦਿਮਾਗ ਸ਼ਾਂਤ ਰੱਖਦਾ ਹੈ ਜਿ ਜਿਸ ਨਾਲ ਕਿ ਅਸੀਂ ਵ ਵਧੀਆ ਫੈਸਲੇ ਲੈ ਸਕਦੇ ਹਾਂ ਅਤੇ ਸ ਅਤੇ ਸਵੇਰੇ ਸਵੇਰੇ ਯੋਗਾ ਕਰਨ ਦਾ ਇਹ ਫਾਇਦਾ ਹੁੰਦਾ ਹੈ ਕਿ ਅਸੀਂ ਸਾਰਾ ਦਿਨ ਸਾਡਾ ਸ਼ ਵਧੀਆ ਠੰਡੇ ਦਿਮਾਗ ਨਾਲ ਚੱਲਦਾ ਹੈ ਅਤੇ ਅਸੀਂ ਆਪਣਾ ਬਿਹਤਰ ਦਿਨ ਕੱਢ ਸਕਦੇ ਹਾਂ